ਉਨੱਤੀ ਸਤੰਬਰ ਦੋ ਹਜ਼ਾਰ ਛੇ ਉਨੱਤੀ ਨਵੰਬਰ ਦੋ ਹਜ਼ਾਰ ਗਿਆਰ੍ਹਾਂ ਤਿੰਨ ਸਤੰਬਰ ਦੋ ਹਜ਼ਾਰ ਪੰਜ ਇੱਕ ਸਤੰਬਰ ਦੋ ਹਜ਼ਾਰ ਪੰਜ ਦੋ ਅਗਸਤ ਦੋ ਹਜ਼ਾਰ ਪੰਜ